ਪਿਛਲੀਆਂ ਛੁੱਟੀਆਂ ਦੇ ਵਿੱਚ ਮੈਂ ਆਪਣੇ ਘਰਦਿਆਂ ਦੇ ਨਾਲ ਕਿਸੇ ਬਾਹਰ ਇਤਿਹਾਸਿਕ ਜਗ੍ਹਾ ਘੁੰਮਣ ਦਾ ਪ੍ਰੋਗਰਾਮ ਬਣਾਇਆ ਮੈਂ ਕੁਝ ਕ ਦਿਨ ਪਹਿਲਾਂ ਹੀ ਆਪਣੀਆਂ ਜਰੂਰੀ ਵਰਤੋਂ ਆ ਜਿਵੇਂ ਕਿ ਕੱਪੜੇ ਅਤੇ ਕੁਝ ਖਾਣ ਪੀਣ ਦਾ ਸਮਾਨ ਪਹਿਲਾਂ ਹੀ ਪੈਕ ਕਰ ਲਿਆ ਪੈਕ ਕਰ ਲਿਆ ਅਸੀਂ ਦੋ ਤਿੰਨ ਘੰਟਿਆਂ ਦੇ ਅੰਦਰ ਬਸ ਰਾਹੀ ਯਾਤਰਾ ਕਰਕੇ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਜੋ ਕਿ ਇੱਕ ਬਹੁਤ ਸੁੰਦਰ ਇਮਾਰਤ ਸੀਗੀ ਜੋ ਕਿ ਇੱਕ ਇਤਿਹਾਸਿਕ ਜਗ੍ਹਾ ਵੀ ਹੈ ਅਸੀਂ ਉੱਥੇ ਜਾ ਕੇ ਰੁਕੇ ਫਿਰ ਅਸੀਂ ਸ਼ਾਮ ਦਾ ਸ਼ਾਮ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਸੁਬਹਾ ਦਾ ਨਾਸ਼ਤਾ ਅਸੀਂ ਉਥੋਂ ਲੰਗਰ ਦੇ ਰੂਪ ਵਿੱਚ ਕੀਤਾ ਜੋ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਤਿਆਰ ਕੀਤਾ ਹੋਇਆ ਸੀ ਅਸੀਂ ਉਥੇ ਇਕ ਘੰਟਾ ਬੈਠ ਕੇ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕੀਤਾ ਅਤੇ ਅਰਦਾਸ ਕੀਤੀ ਫਿਰ ਅਸੀਂ ਉਹ ਤੋਂ ਥੋੜਾ ਦੂਰ ਚੱਲ ਕੇ ਪੈਦਲ ਚੱਲ ਕੇ ਯਾਤਰਾ ਕੀਤੀ ਸਾਰਾ ਗੁਰਦੁਆਰਾ ਸਾਹਿਬ ਘੁੰਮਿਆ ਅਸੀਂ ਉਥੋਂ ਜੋ ਸਾਨੂੰ ਕੋਈ ਚੀਜ਼ਾਂ ਵਧੀਆ ਲੱਗੀਆਂ ਘਰ ਲਈ ਕੁਝ ਕੁ ਸਮਾਨ ਕੁਝ ਕ ਵਸਤੂਆਂ ਕੱਪੜੇ ਕੱਪੜੇ ਜਾਂ ਕੋਈ ਡੈਕੋਰੇਸ਼ਨ ਦਾ ਸਮਾਨ ਅਸੀਂ ਖਰੀਦਿਆਂ ਉਥੋ ਦੀਆਂ ਧਾਰਮਿਕ ਤਸਵੀਰਾਂ ਹਨ ਜਿਵੇਂ ਕਿ ਦਸ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵੀ ਖਰੀਦੀਆਂ ਬੱਸ ਦੇ ਬੱਸ ਰਾਹੀ ਸਾਨੂੰ ਵਧੀਆ ਸੁਵਿਧਾ ਮਿਲੀ ਇਸ ਲਈ ਅਸੀਂ ਵਧੀਆ ਤਰੀਕੇ ਨਾਲ ਸ਼੍ਰੀ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚ ਗਏ ਸਾਨੂੰ ਆਉਣ ਜਾਉਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ ਕਿਉਂਕਿ ਜੋ ਡਰਾਈਵਰ ਬੱਸ ਚਲਾ ਰਿਹਾ ਸੀ ਉਹ ਬਹੁਤ ਵਧੀਆ ਬਹੁਤ ਵਧੀਆ ਸੀ ਉਸ ਦਾ ਸੁਭਾਅ ਵਧੀਆ ਸੀ ਗੱਲਬਾਤ ਕਰਨ ਦਾ ਤਰੀਕਾ ਵਧੀਆ ਸੀ ਅਸੀਂ ਅੰਮ੍ਰਿਤਸਰ ਪਹੁੰਚ ਕੇ ਪਹੁੰਚਣ ਤੋਂ ਬਾਅਦ ਦੋ ਤਿੰਨ ਦਿਨ ਤੱਕ ਉੱਥੇ ਅਸੀਂ ਤਿੰਨ ਦਿਨਾਂ ਬਾਅਦ ਵਾਪਸ ਆ ਗਏ ਰਸਤੇ ਦੇ ਵਿੱਚ ਅਸੀਂ ਬਹੁਤ ਵਧੀਆ ਚੀਜ਼ਾਂ ਦੇਖੀਆਂ ਜਿਵੇਂ ਕਿ ਪੇੜ ਦਰਖਤ ਪੌਦੇ ਫੁੱਲ ਬੂਟੇ ਮੈਦਾਨ ਵਗੈਰਾ ਬਹੁਤ ਵਧੀਆ ਢੰਗ ਨਾਲ ਬਣਾਏ ਹੋਏ ਸਨ ਇਸ ਤਰ੍ਹਾਂ ਸਾਡੀ ਯਾਤਰਾ ਬਹੁਤ ਵਧੀਆ ਰਹੀ